ਹਾਂਜੀ ਹਾਂਜੀ ਮਿਊਜ਼ਿਕ ਟੀਚਰ ਬੋਲ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਮੈਂ ਜਾਨਣਾ ਚਾਹੂੰਗਾ ਕਿ ਤੁਸੀਂ ਸੂਫ਼ੀ ਸਾਰੇ ਚਲੋ ਤੁਹਾਨੂੰ ਦੱਸ ਦਿੰਨੇ ਹੈਗੇ ਸੂਫ਼ੀ ਕਲਾਕਾਰ ਧਾਰਮਿਕ ਅਤੇ ਆਪਣੇ ਪੋਪਸਟਾਰ ਜਿੱਦਾਂ ਕਿ ਜਿਹੜੇ ਆਪਣੇ ਧਾਰਮਿਕ ਹੈ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਲਾ ਸ਼੍ਰੀਨਗਰ ਵਾਲੇ ਅਤੇ ਜਿਵੇਂ ਕਿ ਸੂਫ਼ੀਆਂ 'ਚ ਆ ਜਾਂਦੇ ਨੇ ਹੰਸਰਾਜ ਕਵਰ ਗਰੇਵਾਲ ਅਤੇ ਬੱਬੂ ਮਾਨ ਵਗੈਰਾ ਆ ਜਾਂਦੇ ਨੇ ਜਿਵੇਂ ਕਿ ਦੂਜੇ ਕਲਾਕਾਰਾਂ ਦੇ ਵਿੱਚ ਅਤੇ ਬਹੁਤ ਹੀ ਵਧੀਆ ਕਲਾਕਾਰ ਨੇ ਅਤੇ ਤੁਸੀਂ ਕੀ ਜਾਣਕਾਰੀ ਲੈਣਾ ਚਾਹੁੰਦੇ ਜੀ ਇਹਨਾਂ ਦੇ ਬਾਰੇ ਦੇਖੋ ਜੀ ਇਹਨਾਂ ਨੂੰ ਤੁਸੀਂ ਫੰਕਸ਼ਨ 'ਚ ਬੁਲਾਉਣਾ ਤਾਂ ਦਿਲਜੀਤ ਦੋਸਾਂਝ ਤੁਹਾਨੂੰ ਪਤਾ ਇੱਕ ਬੋਲੀਵੁੱਡ ਚਿਹਰਾ ਬਣ ਚੁੱਕਿਆ ਅਤੇ ਉਹ ਕੋਈ ਉਹਨਾਂ ਦੀ ਪ੍ਰਾਈਜ ਹੈਗਾ ਕੋਈ ਸਾਢੇ ਗਿਆਰਾਂ ਬਾਰਾਂ ਲੱਖ ਰੁਪਈਆ ਫੰਕਸ਼ਨ 'ਤੇ ਸੱਦਣ ਦਾ ਅਤੇ ਬਾਕੀ ਤੁਸੀਂ ਦੂਜਾ ਹੋਰ ਕੁਛ ਵੀ ਹੋਰ ਕੋਈ ਕਲਾਕਾਰ ਜਿਵੇਂ ਬੱਬੂ ਮਾਨ ਹੈ ਉਹ ਕੋਈ ਪੰਦਰਾਂ ਪਲੱਸ ਆ ਜਿਵੇਂ ਗੁਰਦਾਸ ਮਾਨ ਆ ਉਹ ਵੀ ਚੌਦਾਂ ਪੰਦਰਾਂ ਲੱਖ ਆ ਅਤੇ ਇੱਦਾਂ ਇਹਨਾਂ ਦਾ ਪ੍ਰਾਈਜ ਹੈ ਤੁਸੀਂ ਕੇ ਕਿਹੜਾ ਕਲਾਕਾਰ ਲੈਣਾ ਚਾਹੋਂਗੇ ਹਾਂਜੀ ਮੈੈਂ ਇਹਨੂੰ ਇਹਨਾਂ ਦੀਆਂ ਅਕੈਡਮੀਆਂ ਇਹਨਾਂ ਕਲਾਕਾਰਾਂ ਦੀਆਂ ਅਕੈਡਮੀਆਂ ਤਾਂ ਨਹੀਂ ਪਤਾ ਮੈਨੂੰ ਹਜੇ ਫਿਲਹਾਲ ਫਿਰ ਵੀ ਤੁਹਾਨੂੰ ਸ਼ਉਰ ਕਰਕੇ ਅਤੇ ਅਸੀਂ ਦੱਸ ਦਿਆਂਗੇ ਤੁਹਾਨੂੰ ਕੋਂਟੈਕਟ ਕਰ ਲਵਾਂਗੇ ਮੇਰੀ ਦਿੱਤ ਹਾਂਜੀ ਮੇਰੀ ਦਿੱਤੀ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਜੇ ਠੀਕ ਹੈ ਜੀ ਓਕੇ ਜੀ